ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰ ਜੀ ਹੋਰ ਠੀਕ ਹੋ ਘਰ ਪਰਿਵਾਰ ਵਧੀਆ ਮੈਂ ਸੁਣਿਆ ਆਪਣੇ ਅਕਸ਼ੈ ਕੁਮਾਰ ਆਇਆ ਸੀ ਪਿੰਡ ਅਤੇ ਤੁਸੀਂ ਉਹਨਾਂ ਤੋਂ ਮੋਟਰ 'ਤੇ ਇੱਧਰਲੇ ਬੰਬੇ ਵਾਲੇ ਇੱਧਰ ਆ ਕੇ ਬੋਲੀਵੁੱਡ ਆਲੇ ਇੱਧਰ ਆ ਕੇ ਸ਼ੂਟਿੰਗਾਂ ਤਾਂ ਕਰ ਲੈਂਦੇ ਹੈ ਤੁਸੀਂ ਉਹਨਾਂ ਤੋਂ ਕੋਈ ਰੈਂਟ ਭਾੜਾ ਲਿਆ ਇਸਦਾ ਓ ਹੋ ਭਾਅ ਜੀ ਨਹੀਂ ਨਹੀਂ ਉਹ ਤਾਂ ਗੱਲ ਠੀਕ ਹੈਗੀ ਹੈ ਮੈਂ ਤੁਹਾਡੀ ਗੱਲ ਨਾਲ਼ ਸਹਿਮਤ ਹਾਂ ਪਰ ਤੁਸੀਂ ਇੱਕ ਗੱਲ ਦੇਖੋ ਨਾ ਕਿ ਜੇ ਇਹੀ ਚੀਜ਼ਾਂ ਬੋਲੀਵੁੱਡ ਦੀ ਬੰਬੇ ਆਪਣੀ ਪੰਜਾਬੀ ਇੰਡਸਟਰੀ ਜਾਵੇ ਤਾਂ ਸਾਡੇ ਤੋਂ ਕਿੰਨਾ ਕਿਰਾਇਆ ਲੈਂਦੇ ਹੈ ਅਤੇ ਉੱਥੋਂ ਤੇ ਲੋਕ ਵੀ ਤੇ ਤੁਸੀਂ ਇਸ ਨੂੰ ਅਪਣਾ ਸਾਧਨ ਬਣਾਉ ਕੀ ਇਹਦੇ ਨਾਲ਼ ਜਿਹੜਾ ਪੈਸਾ ਆਵੇ ਆਪਾਂ ਆਪਣੇ ਵਾਸਤੇ ਯੂਜ਼ ਕਰ ਸਕੀਏ ਲੋਕਾਂ ਤਾਂ ਇਹ ਅੱਜ ਕੱਲ੍ਹ ਬਿਜ਼ਨਸ ਬਣਾਇਆ ਹੋਇਆ ਹੈਗਾ ਹੂੰ ਹੂੰ

ਮੈਨੂੰ ਪਤਾ ਲੱਗਿਆ ਕਿ ਓਹੀ ਤੁਹਾਡੀ ਮੋਟਰ ਵਿਚ ਕੈਟਰੀਨਾ ਕੈਫ ਦਾ ਡਾਂਸ ਹੋਇਆ ਸੀ ਤੁਹਾਡਾ ਚਵੱਚਾ ਤੋੜ ਗਈ ਉਹ ਅਤੇ ਤੁਸੀਂ ਤੁਸੀਂ ਸੀਮਿੰਟ ਵਧੀਆ ਲਵਾ ਕੇ ਚਵੱਚਾ ਬੜਾ ਕਰਾਵਾ ਲਓ ਆਉਣ ਵਾਲੇ ਟਾਇਮ 'ਚ ਸ਼ੂਟਿੰਗਾਂ ਹੁੰਦੀਆਂ ਰਹਿਣਗੀਆਂ ਅਤੇ ਅਸੀਂ ਚਲੋ ਵਧੀਆ ਹੈਗਾ ਹੈ ਓ ਚਲੋ ਠੀਕ ਹੈ ਵੀਰ ਜੀ ਓਕੇ